ਪੱਚੀ ਅਕਤੂਬਰ ਦੋ ਹਜ਼ਾਰ ਬਾਰ੍ਹਾਂ ਸੱਤ ਫਰਵਰੀ ਉੱਨੀ ਸੌ ਤਰਾਨਵੇਂ ਤਿੰਨ ਮਾਰਚ ਉੱਨੀ ਸੌ ਤ੍ਰੇਹਠ ਚੌਦ੍ਹਾਂ ਦਸੰਬਰ ਉੱਨੀ ਸੌ ਛਿਆਸੀ ਦੱਸ ਫਰਵਰੀ ਉੱਨੀ ਸੌ ਚੁਰਾਨਵੇਂ